ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਵਿੱਚ ਸਥਾਪਿਤ ਕੁਝ ਮਹੱਤਵਪੂਰਨ ਨਿਸ਼ਾਨ ਜੋ ਸਾਡੇ ਸ ਰਾਜ ਪੰਜਾਬ ਰਾਜ ਦੇ ਇਤਿਹਾਸ ਨਾਲ ਜਿਹੜਾ ਵਾ ਉਹ ਸੰਬੰਧਿਤ ਆ ਪੰਜਾਬ ਰਾਜ ਦਾ ਇਤਿਹਾਸ ਇੱਕ ਬਹੁਤ ਅਮੀਰ ਇਤਿਹਾਸ ਆ ਆਪਣੇ ਆਪ ਵਿੱਚ ਇੱਕ ਸੰਪੂਰਨ ਇਤਿਹਾਸ ਜਿਹੜਾ ਵਾ ਉਹ ਮੰਨਿਆ ਜਾਂਦਾ ਠੀਕ ਆ ਜੀ ਇਸ ਤੋਂ ਪਹਿਲਾਂ ਮਤਲਬ ਕਿ ਪੰਜਾਬ ਵਿੱਚ ਸਥਿਤ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਰਿਮੰਦਰ ਸਾਹਿਬ ਦੀ ਜਿਹਨੂੰ ਗੋਲਡਨ ਟੈਂਪਲ ਕਿਹਾ ਜਾਂਦਾ ਜਦੋਂ ਮੁਗਲ ਰਾਜ ਸੀ ਉਦੋਂ ਮੰਨਿਆ ਜਾਂਦਾ ਸੀ ਕੀ ਗੋਲਡਨ ਟੈਂਪਲ ਵਿੱਚ ਜਿਹੜਾ ਸਰੋਵਰ ਆ ਉਹਦੇ ਤੋਂ ਜਿਹੜਾ ਵਾ ਸਿੱਖ ਸ਼ਕਤੀ ਪ੍ਰਾਪਤ ਕਰਦੇ ਆ ਠੀਕ ਹੈ ਇਸ ਲਈ ਮੁਗਲ ਰਾਜ ਵਿੱਚ ਇਹ ਬੜੀ ਦਹਿਸ਼ਤ ਸੀ ਕਿ ਇਹ ਧਾਰਮਿਕ ਸਥਾਨ ਜਿਹੜਾ ਵਾ ਸਿੱਖਾਂ ਨੂੰ ਸ਼ਕਤੀ ਪ੍ਰਦਾਨ ਕਰ ਦਿੰਦਾ ਅਤੇ ਇਹ ਵੀ ਮੰਨਿਆ ਜਾਂਦਾ ਸੀ ਕਿ ਉਸ ਸਰੋਵਰ ਵਿੱਚ ਜਦੋਂ ਜਿਹੜਾ ਕੋਈ ਇਸ਼ਨਾਨ ਕਰਦਾ ਉਹਨੂੰ ਉਹਦੇ ਕਈ ਤਰ੍ਹਾਂ ਦੇ ਦੁੱਖਾਂ ਕਲੇਸ਼ਾਂ ਜਾ ਨਾਸ਼ ਵੀ ਹੋ ਜਾਂਦਾ ਅਤੇ ਅੱਜ ਵੀ ਇਹ ਸ਼ਰਧਾ ਜਿਹੜੀ ਹੈ ਸ਼ਰਧਾਲੂਆਂ ਵਿੱਚ ਹੈਗੀ ਹੈ ਉਹ ਦੁੱਖ ਭੰਜਨੀ ਬੇਰੀ ਦੇ ਥੱਲੇ ਇਸ਼ਨਾਨ ਕਰਕੇ ਆਪਣੇ ਦੁੱਖਾਂ ਕਲੇਸ਼ਾਂ ਦਾ ਜਿਹੜਾ ਵਾ ਉਹ ਨਾਸ਼ ਕਰਵਾਉਂਦੇ ਆ ਇਸ ਮਹਾਨ ਸਥਾਨ ਦੀ ਜਿਹੜੀ ਸਥਾਪਨਾ ਗੁਰੂ ਰਾਮਦਾਸ ਵੀ ਦੁਆਰਾ ਜਿਹੜੀ ਆ ਕੀਤੀ ਕਰਵਾਈ ਗਈ ਸ਼ੁਰੂ ਕਰਵਾਈ ਗਈ ਸੀ ਉਹਨਾਂ ਨੇ ਮਹਾਨ ਪੀਰ ਸਾਈਂ ਮੀਆਂ ਮੀਰ ਜੋ ਤੋਂ ਕਿ ਜਿਹੜੀ ਆ ਇਹਦੀ ਨੀਂਹ ਰਖਵਾਈ ਸੀ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇੱਕ ਆਪਣੇ ਆਪ ਵਿੱਚ ਸੰਪੂਰਨ ਰਾਜ ਜਿਹੜਾ ਸੀ ਉਹ ਮੰਨਿਆ ਜਾਂਦਾ ਸੀ ਖੁਸ਼ਹਾਲ ਰਾਜ ਸੀ ਅਤੇ ਉਹਨਾਂ ਦੇ ਰਾਜ ਦੇ ਵਿੱਚ ਬਹੁਤ ਸਾਰੇ ਜਿਹੜੀ ਆ ਉਹ ਕਿਲਾ ਉਸਾਰੀ ਬਹੁਤ ਸਾਰਾ ਕੁਝ ਜਿਹੜਾ ਵਾ ਹੋਇਆ ਅਤੇ ਲੋਕ ਜਿਹੜੇ ਸੀ ਖੁਸ਼ ਸੀ ਉਸ ਰਾਜ ਵਿੱਚ ਠੀਕ ਉਹਨਾਂ ਦੇ ਮਹਾਨ ਜਿਹੜੇ ਸੰਤ ਜਰਨੈਲ ਸਿਪਾਹੀ ਜਿਹੜੇ ਸੀ ਉਹਨਾਂ ਨੇ ਆਪਣੇ ਵੱਡੇ ਵੱਡੇ ਕਿਲ੍ਹੇ ਜਿਹੜੇ ਆ ਇੱਥੇ ਉਸਾਰੇ ਹੋਏ ਆ ਅਤੇ ਉਹਨਾਂ ਦੀ ਜਿਹੜੀ ਆ ਉਹ ਅੱਜ ਵੀ ਬਰਕਰਾਰ ਆ ਉਹਨਾਂ ਦੀ ਸਾਂਭ ਸੰਭਾਲ ਦੀ ਚਲੋ ਸਮੇਂ ਦੀ ਸਰਕਾਰ ਨੂੰ ਸਾਂਭ ਸੰਭਾਲ ਕਰਨ ਦੀ ਜਿਹੜੀ ਆ ਲੋੜ ਆ ਪਰ ਉਹ ਅੱਜ ਵੀ ਜਿਹੜੇ ਆ ਸਥਾਪਿਤ ਹੈ ਉਦਾਹਰਨ ਦੇ ਤੌਰ 'ਤੇ ਆਪਾਂ ਇੱਧਰ ਵੇਖੀਏ ਅਟਾਰੀ ਬਾਘਾ ਬਾਰਡਰ ਵੱਲ ਜਾਈਏ ਤਾਂ ਅਟਾਰ ਸ਼ਾਮ ਸੋ ਅਟਾਰੀ ਦਾ ਮਹਿਲ ਜਿਹੜਾ ਵਾ ਉਹ ਅੱਜ ਵੀ ਉਸੇ ਉਸੇ ਤਰ੍ਹਾਂ ਹੀ ਜਿਹੜਾ ਵਾ ਉਹ ਸਥਾਪਿਤ ਜਿਹੜਾ ਵਾ ਹੈਗਾ ਵਾ ਹਾਂਜੀ ਹੋਰ ਆਪਣੇ ਧਾਰਮਿਕ ਪੱਖ ਤੋਂ ਪੰਜਾਬ ਨੂੰ ਜਿਹੜਾ ਵਾ ਉਹ ਬਹੁਤ ਜਿਹੜਾ ਵਾ ਮਾਨ ਸਨਮਾਨ ਜਿਹੜਾ ਪੰਜਾਬ ਦੇ ਲੋਕ ਨੂੰ ਪ੍ਰਦਾਨ ਆ ਕੀ ਉਹ ਸੇਵਾ ਭਾਵਨਾ ਉਹਨਾਂ ਵਿੱਚ ਬਹੁਤ ਆ ਸੇਵਾ ਭਾਵਨਾ ਜਿਹੜੀ ਆ ਉਹ ਉਹਦੇ ਵਾਸਤੇ ਥਾਂ ਥਾਂ 'ਤੇ ਗੁਰਦੁਆਰੇ ਜਿਹੜੇ ਮੰਦਿਰ ਜਿਹੜੇ ਆ ਉਸਾਰੇ ਗਏ ਆ ਪੰਜਾਬ ਦੇ ਵਿੱਚ ਜਿਵੇਂ ਹੁਣ ਇੱਕ ਆਪਾਂ ਗੱਲ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦਾ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਤਰਾਂ ਦੇ ਦਾਨੀ ਕਿਹਾ ਜਾਂਦਾ ਅਤੇ ਪੁੱਤਰਾਂ ਦੇ ਦਾਨੀ ਜਿਹੜੇ ਆ ਜਦੋਂ ਇਹਨਾਂ ਦਾ ਮੇਲਾਂ ਹੁੰਦਾ ਅਤੇ ਬੜੀ ਦੂਰੋਂ ਦੂਰੋਂ ਸੰਗਤਾਂ ਜਿਹੜੀਆਂ ਵਾ ਉਹ ਆਪਣੀਆਂ ਜਿਹੜੀਆਂ ਵਾ ਇੱਛਾਵਾਂ ਲੈ ਕੇ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਪਹੁੰਚਦੀਆਂ ਵਾਂ ਪੁੱਤਰਾਂ ਦੀ ਦਾਨ ਦੀ ਅਰਦਾਸ ਬੇਨਤੀ ਕਰਦੀਆਂ ਅਤੇ ਪ੍ਰਾਪਤ ਕਰਦੀਆਂ ਇੱਦਾਂ ਦੇ ਜਿਹੜੇ ਆ ਉਹ ਇਤਿਹਾਸਿਕ ਜਿਹੜੇ ਗੁਰਦੁਆਰੇ ਜਿਹੜੇ ਆ ਪੰਜਾਬ ਵਿੱਚ ਸਥਾਪਿਤ ਆ ਅਤੇ ਇਸ ਲਈ ਪੰਜਾਬ ਦੀ ਜਿਹੜੀ ਹੈ ਇਤਿਹਾਸਿਕ ਪੱਖ ਤੋਂ ਜਿੰਨੇ ਵੀ ਪੱਖ ਇਹਦੇ ਨਾਲ ਜੁੜੇ ਹੋਏ ਆ ਉਹ ਬਹੁਤ ਮਾਣ ਆ ਉਹੀ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਦਰਸਾਉਂਦੇ ਆ ਕਿਉਂਕਿ ਇਹ ਵੀ ਵੇਖੋ ਪੰਜਾਬ ਦੇ ਲੋਕ ਵਿੱਚ ਥਾਂ ਥਾਂ 'ਤੇ ਮਸਜਿਦਾਂ ਮਹਾ ਸਮਾਧਾਂ ਵੋ ਕਈ ਕਿਲ੍ਹੇ ਕਈ ਦਰਵਾਜ਼ੇ ਵੱਡੇ ਵੱਡੇ ਉਸਾਰੇ ਹੋਏ ਆ ਜਿਹੜੇ ਪੰਜਾਬ ਦੇ ਇਤਿਹਾਸ ਨੂੰ ਦਰਸਾਉਂਦੇ ਇਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਅਤੇ ਪੰਜਾਬ ਦਾ ਇਤਿਹਾਸ ਇੱਕ ਬਹੁਤ ਅਮੀਰ ਇਤਿਹਾਸ ਆ ਸੋ ਧੰਨਵਾਦ